ਸਾਡੇ ਖੇਤਰ ਦੇ ਵਿਦਿਆਰਥੀ ਅੱਜ ਡਿਗਰੀਆਂ ਜਿਵੇਂ ਬੀ ਏ ਐੱਮ ਏ ਐੱਮ ਸੀ ਏ ਬੀ ਕੌਮ ਇੰਜੀਨੀਅਰਿੰਗ ਵਾਲੀ ਲਾਈਨ ਦੇ ਵਿੱਚ ਵੀ ਬੱਚੇ ਜਾ ਰਹੇ ਨੇ ਜ਼ਿਆਦਾ ਬੈਂਕਿੰਗ ਦੇ ਵਿੱਚ ਵੀ ਜਾ ਰਹੇ ਨੇ ਕਿਉਂਕਿ ਇਹਦੇ ਬੈਨੀਫਿਟ ਅੱਗੇ ਬੜੇ ਅੱਛੇ ਨੇ ਜਿਹੜਾ ਬੱਚਾ ਐੱਮ ਸੀ ਮਾਸਟਰ ਆਫ ਆਰਟਸ ਕਰ ਰਿਹਾ ਜਾਂ ਬੈਚਲਰ ਆਫ ਆਰਟਸ ਕਰ ਰਿਹਾ ਬੈਚਲਰ ਆਫ ਆਰਟਸ ਵਿੱਚ ਤਾਂ ਐਨੇ ਬੈਨੀਫਿਟ ਨਹੀਂ ਹੈ ਪਰ ਕਈ ਮੈਡੀਕਲ ਨੋਨ ਮੈਡੀਕਲ ਮੈਡੀ ਜਿਹਨੇ ਡਾਕਟਰੀ ਲਾਈਨ ਵਿੱਚ ਜਾਣਾ ਹੈ ਉਹਨੂੰ ਮੈਡੀਕਲ ਕਰਨੀ ਪੈਂਦੀ ਹੈ ਪਲੱਸ ਵੰਨ ਪਲੱਸ ਟੂ ਦੇ ਵਿੱਚ ਅਤੇ ਜਿਹਨੇ ਮਤਲਬ ਇੰਜੀਨੀਅਰਿੰਗ ਲਾਈਨ ਵਿੱਚ ਜਾਣਾ ਹੈ ਤਾਂ ਉਹਨੂੰ ਵੀ ਕਮਰਸ ਕਰਦਾ ਉਹਨੇ ਇੰਜੀਨੀਅਰਿੰਗ ਲਾਈਨ ਅਗਰ ਯੂਜ ਕਰਨੀ ਹੈ ਤਾਂ ਬਾਕੀ ਹੋਰ ਵੀ ਕਈ ਤਰ੍ਹਾਂ ਦੇ ਮਤਲਬ ਕਿ ਖੇਤਰ ਨੇ ਕਈ ਤਰ੍ਹਾਂ ਦੀਆਂ ਡਿਗਰੀਆਂ ਬੱਚੇ ਲੈਂਦੇ ਨੇ ਅਤੇ ਉਹਨਾਂ ਨੂੰ ਡਿਗ ਡਿਗਰੀਆਂ ਦੇ ਰਾਹੀਂ ਉਹਨਾਂ ਦੇ ਹੋਰ ਵੀ ਕਈ ਰਸਤੇ ਖੁੱਲ੍ਹ ਜਾਂਦੇ ਨੇ ਕਈ ਬੱਚੇ ਬਾਹਰ ਜਾਣ ਵਾਸਤੇ ਆਈਲੈਟਸ ਕਰਦੇ ਨੇ ਉਹਨਾਂ ਨੂੰ ਆਈਲੈਟਸ ਦੇ ਵਿੱਚ ਫਿਰ ਕ ਕ ਕਾਫੀ ਬੈਂਡ ਕਿੰ ਬੈਂਡ ਲੈਣੇ ਪੈਂਦੇ ਨੇ ਜੇ ਬੈਂਡ ਉਹਨਾਂ ਦੇ ਆ ਜਾਂਦੇ ਆ ਤਾਂ ਕਈ ਫਿਰ ਮਤਲਬ ਕਿ ਬਾਹਰ ਦਾ ਆਪਣਾ ਸਕੋਪ ਬਣਾ ਲੈਂਦੇ ਨੇ ਬਾਹਰ ਜਾਣ ਵਾਸਤੇ ਕਈ ਬੱਚੇ ਬਾਹਰ ਕੈਨੇਡਾ ਯੂ ਐੱਸ ਏ ਯੂ ਕੇ ਜਾਂਦੇ ਨੇ ਇੰਜੀਨੀਅਰਿੰਗ ਲਾਈਨ ਦੇ ਵਿੱਚ ਵੀ ਪੜ੍ਹਾਈ ਕਰਕੇ ਬੱਚੇ ਬਾਹਰ ਨਿਕਲ ਜਾਂਦੇ ਨੇ ਫਿਰ ਉੱਥੇ ਜਾ ਕੇ ਵੀ ਉਹ ਪੜ੍ਹਾਈ ਕਰਦੇ ਨੇ ਫਿਰ ਉੱਥੇ ਜਾ ਕੇ ਆਪਣੀ ਸੈਟਿੰਗ ਕਰਦੇ ਨੇ ਪਰ ਜੇ ਕਈ ਤਾਂ ਇੰਡੀਆ ਦੇ ਵਿੱਚ ਵੀ ਬਹੁਤ ਵਧੀਆ ਸੈੱਟ ਹੋ ਜਾਂਦੇ ਨੇ ਮੰਨ ਲਉ ਜੇ ਕੋਈ ਨੇ ਕਿਸੇ ਨੇ ਮੈਡੀਕਲ ਕੀਤਾ ਹੈ ਤਾਂ ਉਹਨੂੰ ਫਿਰ ਡਿਗਰੀ ਵਾਸਤੇ ਕਈ ਰੁਪਈਆ ਕਾਫੀ ਰੁਪਈਆ ਲੱਗ ਜਾਂਦਾ ਹੈ ਅਤੇ ਪਰ ਫਿਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਡੋਕਟਰੀ ਵਲ ਵਾਲੀ ਲਾਈਨ ਦੇ ਵਿੱਚ ਫਿਰ ਪੈ ਜਾਂਦੇ ਨੇ ਇੰਜੀਨੀਅਰਿੰਗ ਲਾਈਨ ਬੈਂਕ ਦੇ ਵਿੱਚ ਕਈ ਤਾਂ ਬੱਚੇ ਗੌਰਮੈਂਟ ਦੇ